ਪਟਿਆਲੇ ਜ਼ਿਲ੍ਹੇ 'ਚ ਗੌਰਮੈਂਟ ਮੈਡੀਕਲ ਕੋਲੇਜ ਹੈਗਾ ਹੈ ਰਾਜਿੰਦਰਾ ਹੋਸਪੀਟਲ ਗੌਰਮਿੰਟ ਬਿਕਰਮ ਕੋਲੇਜ਼ ਕਾਮਰਸ ਦਾ ਗੌਰਮਿੰਟ ਮਹਿੰਦਰਾ ਕੋਲੇਜ ਹੈਗਾ ਖਾਲਸਾ ਕੋਲੇਜ ਹੈ ਮੋਦੀ ਕੋਲੇਜ ਹੈ ਪੰਜਾਬੀ ਯੂਨੀਵਰਸਿਟੀ ਹੈ ਅਤੇ ਆਈ ਟੀ ਆਈ ਹੈ ਇੱਥੇ ਇਹਦੇ ਵਿੱਚ ਲੋਕ ਮਤਲਬ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਿੱਤਾਮੁਖੀ ਜਿਹੜੀਆਂ ਕੋਰਸ ਹੈ ਉਹਨਾਂ ਦੇ ਵਿੱਚ ਜਾਂਦੇ ਨੇ ਜਿਵੇਂ ਆਈ ਟੀ ਆਈ ਦੇ ਵਿੱਚ ਜ਼ਿਆਦਾ ਜਾਂਦੇ ਨੇ ਆਈ ਟੀ ਆਈ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਸਟਿਚਿੰਗ ਦਾ ਕੰਮ ਹੋ ਗਿਆ ਬਿਊਟੀਸ਼ਨ ਦਾ ਹੋ ਗਿਆ ਇਹ ਬਹੁਤ ਸਿੱਖਦੇ ਨੇ ਅਤੇ ਕਾਫ਼ੀ ਰਿਆਇਤ ਵੀ ਇਹਦੇ ਵਿਚ ਘੱਟ ਪੈਸੇ ਲੱਗਦੇ ਨੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਬੱਚੇ ਪੜ੍ਹਦੇ ਨੇ ਉੱਥੇ ਵੀ ਬਹੁਤ ਘੱਟ ਖਰਚਾ ਹੁੰਦਾ ਅਤੇ ਉੱਥੇ ਵੀ ਜਿਹੜੇ ਵੀ ਉਹ ਕੋਰਸ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਿੱਤਾਮੁਖੀ ਵੱਲ ਹੀ ਜਾਂਦੇ ਨੇ ਲੜਕੇ ਜਿਵੇਂ ਐਗਰੀਕਲਚਰ ਦਾ ਕਰਦੇ ਨੇ ਜ਼ਿਆਦਾ ਅਤੇ ਆਈ ਟੀ ਆਈ ਦੇ ਵਿੱਚ ਕਰਦੇ ਨੇ ਉਹ ਮਕੈਨੀਕਲ ਦਾ ਇਹਦੇ ਵਿੱਚ ਕਾਫ਼ੀ ਸਾਰੀਆਂ ਅੱਗੇ ਜੌਬਸ ਨੇ ਓਪਰਚਨਿਟੀਸ ਮਿਲ ਜਾਂਦੀਆਂ ਨੇ ਬੱਚਿਆਂ ਨੂੰ ਅਤੇ ਜ਼ਿਆਦਾਤਰ ਪੇਰੇਂਟਸ ਇਹੀ ਕਈਂਦ ਚਾਹੁੰਦੇ ਨੇ ਕਿ ਉਹ ਜਿਹੜੇ ਨੇ ਕਿੱਤਾਮੁਖੀ ਕੋਰਸ ਹੀ ਬੱਚਿਆਂ ਨੂੰ ਕਰਵਾਉਣ ਮਤਲਬ ਉਵੇਂ ਜਿਹੇ ਸਿੱਖਣ ਜਿਹੜੇ ਉਹ ਹੱਥ ਨਾਲ ਵੀ ਕੰਮ ਕਰਕੇ ਕਮਾਈ ਕਰ ਸਕਣ ਜਿਵੇਂ ਪਲੰਬਰ ਦਾ ਕੋਰਸ ਬਹੁਤ ਕਰਵਾਉਂਦੇ ਨੇ ਅਤੇ ਜਾਂ ਕੁਕਿੰਗ ਦੇ ਵਿੱਚ ਵੀ ਕਰਵਾਉਂਦੇ ਨੇ ਜਿਵੇਂ ਇਹ ਸਾਰੇ ਜਿਹੜੇ ਪਲੰਬਰ ਵਗੈਰਾ ਇਹ ਆਈ ਟੀ ਆਈ ਦੇ ਵਿੱਚ ਹੁੰਦੇ ਨੇ ਆਈ ਟੀ ਆਈ ਆਵੈਲਬਲ ਹੈ ਆਪਣੇ ਅਤੇ ਮਹਿੰਦਰਾ ਕੋਲੇਜ ਦੇ ਵਿੱਚ ਵੀ ਬੱਚੇ ਪੜ੍ਹਦੇ ਨੇ ਉੱਥੇ ਫੀਸਾਂ ਦਾ ਕਾਫ਼ੀ ਰਿਆਇਤ ਹੈ ਬਾਕੀ ਪ੍ਰਾਈ ਬ ਬਾਕੀ ਕੋਲੇਜਸ ਦੇ ਵਿ ਨਾਲੋਂ ਉੱਥੇ ਬੱਚੇ ਮਾਸਟਰਜ਼ ਕਰਦੇ ਨੇ ਐੱਮ ਏ ਕਰਦੇ ਨੇ ਬੀ ਏ ਕਰਦੇ ਨੇ ਅੱਗੇ ਹੋਰ ਵੀ ਪੜ੍ਹਾਈਆਂ ਕਰਦੇ ਨੇ ਪੰਜਾਬੀ ਯੂਨੀਵਰਸਟੀ ਤੋਂ ਬਹੁਤ ਬੱਚੇ ਪੜ੍ਹਦੇ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਫੀਸਾਂ ਦਾ ਜਿਹੜਾ ਜ਼ਿਅਦਾ ਨਹੀਂ ਲਈਆਂ ਜਾਂਦੀਆਂ ਬਿਲਕੁਲ ਘੱਟ ਫੀਸਾਂ ਦੇ ਵਿੱਚ ਬੱਚੇ ਵਧੀਆ ਤਰੀਕੇ ਨਾਲ ਪੜ੍ਹ ਲੈਂਦੇ ਨੇ